ਹਾਂਜੀ ਸਾਡੇ ਪੰਜਾਬ ਢਾਬੇ ਤੋਂ ਬੋਲਦੇ ਸਤਿ ਸ਼੍ਰੀ ਅਕਾਲ ਜੀ

ਤੁਹਾਡੇ ਕੋਲ ਖਾਣ ਵਾਸਤੇ ਕੀ ਕੀ ਆਈਟਮ ਆ ਥਾਲੀ ਵਿੱਚ ਕੀ ਕੀ ਆ ਇਹ 'ਚ ਕੀ ਕੀ ਹੁੰਦਾ

ਚਲੋ ਫਿਰ ਪੀਣ ਨੂੰ ਕੀ ਕੀ ਹੁੰਦਾ

ਚਲੋ ਫਿਰ ਅਸੀਂ ਆਉਂਦੇ

ਮਿਠਾਈ 'ਚ ਮਿੱਠੇ 'ਚ ਕੀ ਕੀ ਹੁੰਦਾ ਖੀਰ ਹੁੰਦੀ ਆ ਜੀ

ਠੀਕ ਹੈ

ਠੀਕ ਏ ਚਲੋ